ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਪਿਕਨਿਕ ਲਈ ਹੈੱਡ ਚੁਣਦੀ ਹਾਂ ਜੋ ਕਿ ਇੱਕ ਰੋਪੜ ਦੀ ਮਸ਼ਹੂਰ ਜਗ੍ਹਾ ਹੈ ਔਰ ਉਹ ਮੇਰੇ ਘਰ ਦੇ ਕੋਲ ਵੀ ਹੈ ਥੋੜ੍ਹੇ ਹੀ ਸਮਾਂ ਵਿੱਚ ਆਪਾਂ ਰੋਪੜ ਹੈੱਡ ਪਹੁੰਚ ਜਾਂਦੇ ਹਨ ਉੱਥੇ ਦਾ ਨਜ਼ਾਰਾ ਬਹੁਤ ਅਨੰਦਮਈ ਹੈ ਅਤੇ ਰੌਚਕ ਹੈ ਰੌਚਕ ਹੈ ਮੈਂ ਆਪਣੇ ਖਾਲੀ ਸਮੇਂ ਵਿੱਚ ਕਿਤਾਬਾਂ ਪੜ੍ਹ ਲੈਂਦੀ ਹਾਂ ਅਤੇ ਕੁਛ ਕਲਾਕਾਰੀ ਅਤੇ ਚਿੱਤਰ ਵੀ ਬਣਾਉਂਦੀ ਹਾਂ